ਪੰਜਾਬੀ ਅਤੇ ਗੈਰ ਪੰਜਾਬੀ ਦੋਵੇਂ ਸਮਕਾਲੀ ਭਾਰਤੀ ਲੇਖਕ ਬਹੁਤ ਹਨ ਜਿਹਨਾਂ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬੀ ਸੱਭਿਆਚਾਰ ਵਿੱਚ ਭਰਪੂਰ ਯੋਗਦਾਨ ਪਾਇਆ ਹੈ ਮੈਂ ਅੱਜ ਗੱਲ ਕਰਨਾ ਚਾਹੁੰਦਾ ਹਾਂ ਨਾਨਕ ਸਿੰਘ ਜੀ ਦੀ ਜੋ ਇੱਕ ਬਹੁਤ ਹੀ ਪੰਜਾਬੀ ਮਸ਼ਹੂਰ ਲੇਖਕ ਹੋਏ ਹਨ ਜਿਹਨਾਂ ਨੇ ਪੰਜਾਬ ਦਾ ਇਹੋ ਜਿਹਾ ਦ੍ਰਿਸ਼ ਦਰਸਾਇਆ ਹੈ ਜੋ ਕਿ ਸਿਰਫ ਕਿਤਾਬਾਂ ਵਿੱਚ ਹੀ ਰਹਿ ਗਿਆ ਸੀ ਪਰ ਉਹਨਾਂ ਨੇ ਹਰੇਕ ਦੇ ਜ਼ੁਬਾਨੀ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਆਪਣੀਆਂ ਰਚਨਾਵਾਂ ਰਾਹੀਂ ਲਿਆਂਦਾ ਹੈ ਤਾਂ ਜੋ ਪੰਜਾਬ ਦਾ ਸੱਭਿਆਚਾਰ ਲੋਕ ਕਲਾਵਾਂ ਲੋਕ ਗੀਤ ਕਿਤੇ ਲੁਕੇ ਨਾ ਰਹਿ ਜਾਣ ਤਾਂ ਕਿ ਹਰੇਕ ਪੰਜਾਬੀ ਨੂੰ ਹਰੇਕ ਪੰਜਾਬੀ ਰਚਨਾ ਬਾਰੇ ਗਿਆਨ ਹੋਵੇ ਤਾਂ ਪਤਾ ਲੱਗੇ ਵੀ ਪੰਜਾਬੀ ਵਿੱਚ ਪੰਜਾਬ ਵਿੱਚ ਅਸਲ ਹੈ ਕੀ ਤੋ ਇਸ ਤਰ੍ਹਾਂ ਹੀ ਸੰਤ ਸ਼ੇਖ ਫਰੀਦ ਜੀ ਹੋਏ ਹਨ ਜਿਹਨਾਂ ਦੀਆਂ ਬਹੁਤ ਹੀ ਸਾਰੀਆਂ ਰਚਨਾਵਾਂ ਜਾਂ ਸਲੋਕ ਕਵਿਤਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ ਜੋ ਕਿ ਬਹੁਤ ਹੀ ਮਸ਼ਹੂਰ ਹਨ ਇੱਕ ਹੋਰ ਸੰਤ ਹੋਏ ਹਨ ਜਿਹਨਾਂ ਨੇ ਜੀਵਨ ਜਾਚ ਬਾਰੇ ਦੱਸਿਆ ਹੈ ਉਹ ਇੱਕ ਪੰਜਾਬੀ ਨਹੀਂ ਹਨ ਪਰ ਉਹਨਾਂ ਨੇ ਪੰਜਾਬ ਦੇ ਬਾਰੇ ਬਹੁਤ ਹੀ ਕੁਝ ਦੱਸਿਆ ਹੈ ਕਿ ਕਿਵੇਂ ਜੀਵਨ ਜਾਚ ਹਰੇਕ ਵਿਅਕਤੀ ਜੀਅ ਸਕਦਾ ਜੋ ਵਿਅਕਤੀ ਇਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਦਾ ਹੈ ਉਹ ਕਿਸੇ ਨਾ ਕਿਸੇ ਦਿਨ ਇਹਨਾਂ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਪੋਜਟਿਵ ਚੇਂਜ ਲਿਆਉਂਦਾ ਹੈ